ਸਾਡੇ ਖੇਤਰ ਵਿੱਚ ਕੁਦਰਤੀ ਸਰੋਤ ਸਤਲੁਜ ਦਰਿਆ ਹੈ ਅਤੇ ਬਹੁਤ ਤਰ੍ਹਾਂ ਦੇ ਪਹਾੜ ਹਨ ਜਿੱਥੋਂ ਬਹੁਤ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਮਿਲਦੀਆਂ ਹਨ